ਕੱਲ ਅਸੀਂ ਰਾਤੀ ਔਨਲਾਈਨ ਔਰਡਰ ਕਰਕੇ ਦੱਖਣੀ ਭਾਰਤ ਦਾ ਇੱਕ ਪ੍ਰਸਿੱਧ ਜੋ ਭੋਜਨ ਮੰਨਿਆ ਜਾਂਦਾ ਹੈ ਇਡਲੀ ਡੋਸਾ ਸਾਂਬਰ ਅਤੇ ਨਾਲ ਹੀ ਨਾਰੀਅਲ ਦੀ ਚਟਨੀ ਔਨਲਾਈਨ ਸਵਿਗੀ ਤੋਂ ਮੰਗਵਾਈ ਸੀ ਰਾਤ ਸਾਡਾ ਬਹੁਤ ਘੱਟ ਖਾਣਾ ਲੱਗਿਆ ਅਤੇ ਸਵੇਰ ਤੱਕ ਸਾਡੇ ਕੋਲ ਕਾਫੀ ਜ਼ਿਆਦਾ ਸਾਂਬਰ ਅਤੇ ਨਾਰੀਅਲ ਦੀ ਚਟਨੀ ਬਚ ਗਈ ਸੀ ਸੋ ਹੁਣ ਮੈਂ ਸੋਚਿਆ ਕਿ ਭੋਜਨ ਨੂੰ ਇੱਦਾਂ ਸੁੱਟਣ ਦੀ ਬਜਾਏ ਕਿਉਂ ਨਾ ਮੈਂ ਉਹਨੂੰ ਆਪਣੇ ਉੱਤਰੀ ਭਾਰਤ ਦੇ ਪ੍ਰਸਿੱਧ ਜੋ ਦੇਸੀ ਘਿਓ ਦੇ ਪਰੌਂਠੇ ਹੁੰਦੇ ਹਨ ਉਹਨਾਂ ਦੇ ਨਾਲ ਖਾ ਕੇ ਇੱਕ ਤਰ੍ਹਾਂ ਨਾਲ ਭੋਜਨ ਦੀ ਬੇਅਦਬੀ ਹੋਣ ਬਚਾ ਲਵਾਂ ਅਤੇ ਇੱਕ ਨਵਾਂ ਸੱਭਿਆਚਾਰਕ ਪਰੰ ਪਰੰਪਰਾਵਾਂ ਦੇ ਤੱਤਾਂ ਨੂੰ ਜੋੜ ਕੇ ਇੱਕ ਨਵਾਂ ਭੋਜਨ ਬਣਾ ਕੇ ਦੇਖਿਆ ਜਾਵੇ ਅਤੇ ਉਹਦੇ ਸਵਾਦ ਨੂੰ ਵੀ ਚੱਖਿਆ ਜਾਵੇ ਕਿ ਕਿਸ ਤਰ੍ਹਾਂ ਦਾ ਲੱਗਦਾ ਹੈ ਸੋ ਜਦੋਂ ਮੈਂ ਅਖੀਰ ਦੇ ਵਿੱਚ ਦੇਸੀ ਘਿਓ ਦੇ ਪਰੌਂਠਿਆਂ ਦੇ ਨਾਲ ਨਾਰੀਅਲ ਦੀ ਚਟਨੀ ਸਾਂਬਰ ਜੋ ਕਿ ਘਈ ਕੜੀ ਪੱਤੇ ਦੇ ਤੜਕੇ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਇੱਕ ਸਵਾਦ ਦੇ ਰਹੇ ਸੀ ਜਿਹਨੂੰ ਕਿ ਜਦੋਂ ਮੈਂ ਬਣਾਇਆ ਤਾ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤਾਂ ਮੈਨੂੰ ਲੱਗਿਆ ਕਿ ਸਾਨੂੰ ਇਸ ਤਰ੍ਹਾਂ ਅਲੱਗ ਅਲੱਗ ਸੱਭਿਆਚਾਰਕ ਪਰੰਪਰਾਵਾਂ ਦੇ ਭੋਜਨਾਂ ਦੇ ਸੁਮੇਲ ਕਰਕੇ ਕੁਛ ਨਾ ਕੁਛ ਬਣਾ ਕੇ ਖਾਣਾ ਚਾਹੀਦਾ ਹੈ ਤਾਂ ਕਿ ਸਾਨੂੰ ਨਵੀਆਂ ਜੋ ਹੈ ਚੀਜ਼ਾਂ ਦਾ ਪਤਾ ਲੱਗ ਸਕੇ ਇਸ ਤਰ੍ਹਾਂ ਜਦੋਂ ਮੈਂ ਆਪਣਾ ਖਾਇਆ ਤਾ ਭੋਜਨ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਅਤੇ ਸਭ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ